ਆਧਾਰ ਕਾਰਡ ਸਾਡੇ ਜ਼ਰੂਰੀ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਪਰ ਕੀ ਤੁਸੀਂ ਯੂ ਆਈ ਡੀ ਏ ਆਈ ਤੁਹਾਨੂੰ ਆਧਾਰ ਦੇ ਬਾਇਓ ਮੈਟਰਿਕ ਦਾ ਵਿਕਲਪ ਵੀ ਦਿੰਦਾ ਹੈ ਯੂਜਰਜ ਆਪਣੇ ਹਿਸਾਬ ਨਾਲ ਇਸ ਨੂੰ ਲਾਕ ਜਾਂ ਅਨਲਾਗ ਕਰ ਸਕਦੇ ਨੇ ਅਜਿਹਾ ਕਰਨ ਨਾਲ ਆਧਾਰ ਧਾਰਕ ਕਰਮਾਵਿਤਾ ਲਈ ਆਪਣੇ ਬਾਇਓ ਮੈਟਰਿਕ ਡੇਟਾ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੇ ਆਧਾਰ ਬਾਇਓਮੈਟਰਿਕ ਡੇਟਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਲੋੜ ਨਾ ਹੋਣ 'ਤੇ ਅਸੀਂ ਆਪਣੇ ਆਧਾਰ ਨੂੰ ਲਾਕ ਜਾਂ ਅਨਲਾਗ ਕਰ ਸਕਦੇ